ਮੇਰਾ ਮਨਪਸੰਦ ਟੀ ਵੀ ਸ਼ੋਅ ਹਿੰਦੀ ਸ਼ੋਅ ਹੈ ਜੋ ਕਿ ਜਿਸਦਾ ਨਾਮ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਹੈ ਉਸ ਸ਼ੋਅ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਜਦੋਂ ਵੀ ਮੈਂ ਆਪਣੇ ਆਪ ਨੂੰ ਉਦਾਸ ਮਹਿਸੂਸ ਕਰਦਾ ਹਾਂ ਮੈਂ ਆਪਣੇ ਕਮਰੇ 'ਚ ਇਕੱਲਾ ਬੈਠ ਜਾਂਦਾ ਹਾਂ ਅਤੇ ਟੀ ਵੀ ਔਨ ਕਰਕੇ ਇਹ ਸ਼ੋਅ ਦੇਖਣ ਲੱਗ ਜਾਂਦਾ ਹਾਂ ਇਸ ਸ਼ੋਅ ਨੂੰ ਦੇਖ ਕੇ ਇਹ ਸ਼ੋਅ ਬਹੁਤ ਹੀ ਮਨੋਰੰਜਨ ਵਾਲਾ ਹੈ ਇਸ ਸ਼ੋਅ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਬਹੁਤ ਹੀ ਮਨੋਰੰਜਨ ਅਤੇ ਖੁਸ਼ ਮਹਿਸੂਸ ਕਰਦਾ ਹਾਂ ਅਤੇ ਇਸ ਸ਼ੋਅ ਨੂੰ ਮੈਂ ਬਹੁਤ ਹੀ ਲੰਬੇ ਟਾਈਮ ਤੋਂ ਦੇਖਦਾ ਆ ਰਿਹਾ ਹਾਂ ਇਸ ਸ਼ੋਅ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਇਹ ਪਸੰਦ ਹੈ ਕਿ ਇਹ ਸ਼ੋਅ ਪਰਿਵਾਰਕ ਹੈ ਅਸੀਂ ਇਹਨੂੰ ਆਪਣੇ ਪਰਿਵਾਰ ਨਾਲ਼ ਬੈਠ ਕੇ ਵੀ ਦੇਖ ਸਕਦੇ ਹਨ ਅਤੇ ਇਸ ਸ਼ੋਅ ਨੂੰ ਦੇਖ ਕੇ ਮੈਂ ਹਮੇਸ਼ਾ ਹੀ ਹੱਸਦਾ ਰਹਿੰਦਾ ਹਾਂ ਅਤੇ ਖੁਸ਼ੀ ਮਹਿਸੂਸ ਕਰਦਾ ਹਾਂ